ਯੋਗਾ ਕਰਨਾ ਮੈਨੂੰ ਬਹੁਤ ਹੀ ਪਸੰਦ ਹੈ ਅਤੇ ਮੈਂ ਰੋਜ਼ ਹੀ ਯੋਗਾ 'ਤੇ ਜਾਨੀ ਹਾਂ ਜਿੱਥੇ ਮੈਂ ਕਲਾਸ ਲੈਣ ਜਾਨੀ ਹਾਂ ਉੱਥੇ ਰੋਜ਼ ਦੇ ਘੱਟ ਤੋਂ ਘੱਟ ਪੰਜਾਹ ਸੱਠ ਬੰਦੇ ਆਉਂਦੇ ਆ ਯੋਗਾ ਕਰਨ ਨਾਲ ਨਾ ਅਸੀਂ ਇਕਦਮ ਤਰੋ ਤਾਜ਼ਾ ਹੋ ਜਾਂਦੇ ਹਾਂ ਜਿਹਦੇ ਨਾਲ ਸਾਡਾ ਸਰੀਰ ਅਤੇ ਦਿਮਾਗ ਦੋਨੋਂ ਹੀ ਬਹੁਤ ਤਰੋ ਤਾਜ਼ਾ ਇਕਦਮ ਫਰੈਸ਼ ਮਹਿਸੂਸ ਕਰਦੇ ਹਨ ਅਤੇ ਅੱਜ ਕੱਲ੍ਹ ਦੇ ਮੈਂ ਤਾਂ ਕਹਿੰਦੀ ਸਾਰੇ ਯੂਥ ਨੂੰ ਯੋਗਾ ਕਰਨਾ ਚਾਹੀਦਾ ਜਿੰਨਾ ਕੁ ਮਤਲਬ ਤੁਸੀਂ ਉਹਦੇ ਨਾਲ ਅੱਜ ਕੱਲ੍ਹ ਬਿਮਾਰੀਆਂ ਬਿਮਾਰੀਆਂ ਤੋਂ ਬਚਣ ਲਈ ਹਰ ਬੰਦੇ ਨੂੰ ਯੋਗਾ ਕਰਨਾ ਚਾਹੀਦਾ ਇਹਦੀ ਕੋਈ ਉਮਰ ਨਹੀਂ ਹੈਗੀ ਬੁੱਢਾ ਜਵਾਨ ਬੱਚਾ ਕੋਈ ਵੀ ਕਰ ਸਕਦਾ ਅਤੇ ਤੁਸੀਂ ਤੁਹਾਨੂੰ ਬਹੁਤ ਅੱਛਾ ਫੀਲ ਹੁੰਦਾ ਦੂਜੀ ਗੱਲ ਤੁਸੀਂ ਜਦੋਂ ਸਵੇਰੇ ਬਾਹਰ ਜਾਂਦੇ ਹੋ ਯੋਗਾ ਕਰਨ ਸਵੇਰ ਦੀ ਫਰੈਸ਼ ਹਵਾ 'ਚ ਤੁਹਾਡਾ ਦਿਲ ਦਿਮਾਗ ਇਕਦਮ ਤਰੋ ਤਾਜ਼ਾ ਹੋ ਜਾਂਦਾ ਨਾਲੇ ਤੁਸੀਂ ਉੱਥੇ ਭਰਾਵਾਂ ਭੈਣਾਂ ਨੂੰ ਜਦੋਂ ਮਿਲਦੇ ਆ ਗੱਪ ਸ਼ੱਪ ਮਾਰਦੇ ਹਾਂ ਤੁਸੀਂ ਉੱਦਾਂ ਹੀ ਬੜਾ ਫਰੈਸ਼ ਫੀਲ ਕਰਦੇ ਆ ਤਾਂ ਯੋਗਾ ਇੱਕ ਬਹੁਤ ਅੱਛੀ ਚੀਜ਼ ਹੈ ਇਹ ਹਰ ਬੰਦੇ ਨੂੰ ਕਰਨੀ ਚਾਹੀਦੀ ਹੈ ਇਹਦੇ 'ਚ ਤੁਸੀਂ ਜੇ ਜਿਹੜੀ ਉਹ ਅਲੱਗ ਅਲੱਗ ਤਰ੍ਹਾਂ ਦੇ ਆਸਣ ਕੀਤੇ ਜਾਂਦੇ ਹਨ ਹਰ ਇੱਕ ਇੱਕ ਸਰੀਰ ਦੇ ਅੰਗ ਦਾ ਆਸਣ ਹੁੰਦਾ ਜਿਹਦੇ ਨਾਲ ਅਗਰ ਤੁਹਾਨੂੰ ਕੋਈ ਸਰੀਰ 'ਚ ਕੋਈ ਵੀ ਪ੍ਰੋਬਲਮ ਹੋਵੇ ਤਾਂ ਉਹ ਤੁਹਾਨੂੰ ਉਹਦੇ ਨਾਲ ਤੁਹਾਡੀ ਬਿਲਕੁਲ ਠੀਕ ਹੋ ਜਾਂਦੀ ਹੈ ਤੁਹਾਨੂੰ ਕੋਈ ਵੀ ਬਿਮਾਰੀ ਨਹੀਂ ਲੱਗਦੀ ਤੁਸੀਂ ਇੱਦਾਂ ਫੀਲ ਕਰਦੇ ਆ ਕਿ ਜਿੱਦਾਂ ਤੁਸੀਂ ਅੱਜ ਵੀ ਬਿਲਕੁਲ ਤਰੋ ਤਾਜ਼ਾ ਤਾਜ਼ੇ ਔਰ ਇਕਦਮ ਜਵਾਨ ਹੋ ਯੋਗਾ ਕਰਨ ਨਾਲ ਤੁਸੀਂ ਹਮੇਸ਼ਾ ਫਿਟ ਫਰੈਸ਼ ਫੀਲ ਕਰਦੇ ਹੋ ਔਰ ਫਰੈਸ਼ ਹੀ ਰਹਿੰਦੇ ਹੋ ਮੈਂ ਤਾਂ ਜਿਸ ਦਿਨ ਯੋਗਾ ਨਾ ਕਰਾਂ ਮੈਨੂੰ ਇੱਦਾਂ ਲੱਗਦਾ ਕਿ ਅੱਜ ਪਤਾ ਨਹੀਂ ਕੀ ਰਹਿ ਗਿਆ ਇਸ ਕਰਕੇ ਮੈਂ ਤਾਂ ਇਹੀ ਪ੍ਰੈਫਰ ਕਰਦੀ ਹਾਂ ਕਿ ਹਰ ਬੰਦੇ ਨੂੰ ਰੋਜ਼ ਯੋਗਾ ਕਰਨਾ ਚਾਹੀਦਾ ਆਪਣੇ ਲਈ ਇੱਕ ਘੰਟਾ ਜ਼ਰੂਰ ਕੱਢਣਾ ਚਾਹੀਦਾ ਹੈ ਕਿਉਂਕਿ ਯੋਗਾ ਐਕਸਰਸਾਈਜ਼ ਵਿਆਮ ਇਹ ਸਰੀਰ ਲਈ ਬਹੁਤ ਹੀ ਅੱਛਾ ਹੈ ਇਹ ਹਰ ਬੰਦਾ ਕਰੇ ਕਿਉਂਕਿ ਇਹਦੇ ਬਹੁਤ ਹੀ ਫਾਇਦੇ ਆ ਕਿ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਤੁਸੀਂ ਕਿਸੇ ਵੀ ਬਿਮਾਰੀ ਨਾਲ ਜੂਝਦੇ ਪਏ ਆ ਤਾਂ ਯੋਗਾ ਜ਼ਰੂਰ ਕਰੋ ਯੋਗਾ ਵੱਡੀ ਤੋਂ ਵੱਡੀ ਬਿਮਾਰੀ ਨੂੰ ਠੀਕ ਕਰਨ ਦੀ ਸ਼ਮਤਾ ਰੱਖਦਾ ਆਪਣੇ ਆਪ 'ਚ ਹਰ ਬੰਦੇ ਨੂੰ ਯੋਗਾ ਕਰਨਾ ਚਾਹੀਦਾ